ਹਾਂਜੀ ਪਹਿਲਾਂ ਦੇ ਸਮੇਂ ਵਿੱਚ ਖੁੱਲ੍ਹੇ ਪਖਾਨਿਆਂ ਵਿੱਚ ਜਾਣਾ ਪੰਜਾਬੀਆਂ ਲਈ ਆਮ ਗੱਲ ਸੀ ਕਿਉਂਕਿ ਉਸ ਟਾਈਮ ਹਰ ਇੱਕ ਦੇ ਘਰ ਵਿੱਚ ਪਖਾਨਾ ਨਹੀਂ ਬਣਿਆ ਵਿਆ ਸੀਗਾ ਜਿਸ ਕਰਕੇ ਲੋਕ ਖੁੱਲ੍ਹੇ ਵਿੱਚ ਹੀ ਜਾਂਦੇ ਸਨ ਜਿਸ ਨਾਲ ਕੀ ਆ ਬਹੁਤ ਸਾਰੀਆਂ ਬਿਮਾਰੀਆਂ ਵੀ ਫੈਲੀਆਂ ਸ ਫੈਲਦੀਆਂ ਹਨ ਅਤੇ ਇਹ ਬਹੁਤ ਹੀ ਗਲਤ ਗੱਲ ਹੈ ਅਤੇ ਅੱਜ ਹੁਣ ਪੰਜਾਬ ਸਰਕਾਰ ਨੇ ਪਬਲਿਕ ਟੋਇਲੇਟ ਬਣਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਅਤੇ ਹੁਣ ਅੱਜ ਕੱਲ੍ਹ ਲੋਕ ਤਰੱਕੀ ਵੱਲ ਵੱਧਦੇ ਜਾ ਰਹੇ ਹਨ ਐਸ ਸੀ ਕੈਟਾਗਰੀ ਜਾ ਨੀਚਲੀ ਜਾਤੀਆਂ ਨੂੰ ਬਹੁਤ ਹੀ ਲਾਭ ਦਿੱਤੇ ਗਏ ਹਨ ਉਹਨਾਂ ਨੂੰ ਸਕਾਲਰਸ਼ਿਪ ਬੱਚਿਆਂ ਨੂੰ ਦਿੱਤੀ ਗਈ ਹੈ ਕਾਫ਼ੀ ਸੁਵਿਧਾ ਸਹਾਇਤਾ ਕੀਤੀ ਗਈ ਹੈ ਅਤੇ ਹਰ ਇੱਕ ਦੇ ਘਰ ਦੇ ਵਿੱਚ ਹੁਣ ਤਾਂ ਪਖਾਨਾ ਬਣਾ ਦਿੱਤਾ ਗਿਆ ਹੈ ਜਿਸ ਨਾਲ ਬਹੁਤ ਹੀ ਬਿਮਾਰੀਆਂ ਵੀ ਘਟੀਆਂ ਹਨ

ਪਹਿਲਾਂ ਦੇ ਸਮੇਂ ਨਾਲੋਂ ਤਾਂ ਅੱਜ ਕੱਲ੍ਹ ਬਹੁਤ ਹੀ ਵਧੀਆ ਯਾਨੀ ਕਿ ਸੁਧਾਰ ਹੋਇਆ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਅਤੇ ਹੋਰ ਉਹ ਉਹਨਾਂ ਪਹਿਲਾਂ ਦੇ ਸਮੇਂ ਵਿੱਚ ਕਿਉਂਕਿ ਬਜ਼ੁਰਗਾਂ ਨੂੰ ਇਨਾ ਨਹੀਂ ਪਤਾ ਸੀਗਾ ਵੀ ਹੈ ਨਾ ਇਸ ਨਾਲ ਕੀ ਇਸਦੇ ਨੁਕਸਾਨ ਹੁੰਦੇ ਹਨ ਅਤੇ ਕ ਕੀ ਈ ਕਿਉਂ ਇਹ ਮਾੜੀ ਗੱਲ ਹੈ ਅਤੇ ਹੁਣ ਦੇ ਲੋਕ ਇੰਨੇ ਤਾਂ ਜਾਗਰੂਕ ਹੋ ਚੁੱਕੇ ਹਨ ਕਿ ਆਪਣੇ ਲਈ ਕੀ ਸਹੀ ਹੈ ਅਤੇ ਕੀ ਨਹੀਂ ਅਤੇ ਅੱਜ ਕੱਲ੍ਹ ਤਾਂ ਇਹ ਆਮ ਹੋਇਆ ਕਿ ਸਾਰਿਆਂ ਦੇ ਘਰ ਦੇ ਵਿੱਚ ਲਗਭਗ ਉਸ ਪਖਾਨਾ ਬਣ ਗਿਆ ਹੈ ਕੋਈ ਵੀ ਹੁਣ ਖੁੱਲ੍ਹੇ ਵਿੱਚ ਨਹੀਂ ਜਾਂਦਾ ਹੈ ਲੇਕਿਨ ਹਜੇ ਵੀ ਕੁਝ ਕੁ ਇਹੋ ਜਿਹੇ ਪਿਛੜੇ ਵਰਗ ਜਾਂ ਕੁਝ ਕੁ ਪਿੰਡ ਹਨ ਜਿੱਥੇ ਲ ਲੋਕ ਹਜੇ ਵੀ ਉੱਥੇ ਜਾਂਦੇ ਹਨ